ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਧ ਧਰਮ ਹਨ ਧਾਰਮਿਕ ਲੋਕ ਰਹਿੰਦੇ ਹਨ ਜਿਵੇਂ ਕਿ ਹਿੰਦੂ ਮੁਸਲਮਾਨ ਸਿੱਖ ਕ੍ਰਿਸਚਨ ਬੋਧੀ ਜੈਨੀ ਇਹ ਸਾਰੇ ਰਹਿੰਦੇ ਹਨ ਅਤੇ ਇਹਨਾਂ ਵਿੱਚ ਪੰਜਾਬ ਦੇ ਵਿੱਚ ਖਾਸ ਕਰਕੇ ਸਾਰੇ ਰਲ ਮਿਲ ਕੇ ਰਹਿੰਦੇ ਹਨ ਬੜਾ ਇੱਕ ਦੂਜੇ ਨੂੰ ਸਤਿਕਾਰ ਕਰਦੇ ਹਨ ਇਹਨਾਂ ਦੇ ਵਿੱਚ ਬੜੀ ਸਹਿਣਸ਼ੀਲਤਾ ਹੁੰਦੀ ਹੈ ਬੜੇ ਇੱਕ ਦੂਜੇ ਨਾਲ ਸਹਿਯੋਗ ਵੀ ਕਰਦੇ ਹਨ ਕੋਈ ਵੀ ਕਾਰਜ ਕਰਨਾ ਹੁੰਦਾ ਹੈ ਕੋਈ ਪਿੰਡ ਦੇ ਵਿੱਚ ਜਾਂ ਕੋਈ ਸ਼ਹਿਰ ਦੇ ਵਿੱਚ ਕੋਈ ਵੀ ਕਾਰਜ ਕਰਨਾ ਹੁੰਦਾ ਹੈ ਤਾਂ ਸਾਰੇ ਹੀ ਰਲ ਮਿਲ ਕੇ ਇਹ ਕਾਰਜ ਆਪਣਾ ਜੋ ਕਾਰਜ ਕਰਦੇ ਹਨ